ਸਿਲਾਈ ਸਮੇਂ ਮੈਨੂੰ ਬਹੁਤ ਦਿੱਕਤ ਕਈ ਵਾਰ ਸੂਟ ਖਰਾਬ ਹੋ ਜਾਂਦਾ ਠੀਕ ਹੈ ਮੇਰੇ ਤੋਂ ਕਟਿੰਗ ਗਲਤ ਹੋ ਜਾਂਦੀ ਲੇਕਿਨ ਫੇਰ ਰੋਜ਼ ਬਹੁਤ ਜ਼ਿਆਦਾ ਦਿੱਕਤ ਆਉਂਦੀ ਫੇਰ ਅਗਲੇ ਦਾ ਕਹਿਣਾ ਕੱਪੜਾ ਮੇਰਾ ਖਰਾਬ ਕਰ ਦਿੱਤਾ ਕੋਈ ਨਾ ਦਿੱਖ ਇਹ ਸਭ ਜਦੋਂ ਆਪਾਂ ਕੋਈ ਕੰਮ ਕਰਦੇ ਆਪਾਂ ਗਲਤ ਗਲਤੀ ਜ਼ਰੂਰ ਬੰਦੇ ਤੋਂ ਹੋ ਜਾਂਦੀ ਸਹੀ ਸਹੀ ਵੀ ਹੋ ਜਾਂਦਾ ਕਈ ਵਾਰ ਗਲਤ ਵੀ ਹੋ ਜਾਂਦਾ ਗਲਤ ਹੋ ਜਾਂਦਾ ਫਿਰ ਲੋਕੀਂ ਕਹਿੰਦੇ ਗਲਤ ਹੋ ਗਿਆ ਕੋਈ ਨਾ ਫਿਰ ਅਸੀਂ ਅਗਲਿਆਂ ਨੂੰ ਗਾਈਡ ਕਰ ਦਿੰਦੇ ਉਹਨੂੰ ਸਹੀ ਕਰ ਦਿੰਦੇ ਕਿਸੇ ਤਰੀਕੇ ਨਾਲ ਆਪਾਂ ਸਹੀ ਕਰਨਾ ਕਰਦੇ ਕਿ ਨਹੀਂ ਇਹ ਸਹੀ ਹੋ ਕੇ ਅਗਲੇ ਦੇ ਠੀਕ ਹੋ ਜਾਏ ਸਲਵਾਰ ਕਈ ਵਾਰ ਸਹੀ ਨਹੀਂ ਕੱਟ ਹੋੇਈ ਕੋਈ ਕਹਿੰਦਾ ਚੋਣਾਂ ਵਾਲੀ ਹੈ ਕਈ ਵਾਰ ਆਪਾਂ ਤੋਂ ਗਲਤ ਕੱਟ ਹੋ ਜਾਂਦੀ ਘੱਟ ਚੋਣਾਂ ਪੈ ਜਾਂਦੀਆਂ ਫਿਰ ਅਗਲਾ ਕਹਿੰਦਾ ਨਹੀਂ ਪਟਿਆਲਾ ਸਲਵਾਰ ਚਾਹੀਦੀ ਸੀ ਤੁਸੀਂ ਗਲਤ ਬਣਾ ਤਾਂ ਨਹੀਂ ਇਹ ਤਾਂ ਮੈਨੂੰ ਚੰਗਾ ਨਹੀਂ ਮੇਰਾ ਸੂਟ ਖਰਾਬ ਕਰ ਦਿੱਤਾ ਮੈਂ ਤਾਂ ਵਿਆਹ ਨੂੰ ਜਾਣਾ ਸੀ ਦੱਸੋ ਮੈਂ ਕੀ ਕਰਾਂ ਕੀ ਪਾਵਾਂ ਫਿਰ ਅਗਲੇ ਨੂੰ ਕਹਿੰਦੇ ਹਾਂ ਕੋਈ ਗੱਲ ਨਹੀਂ ਤੂੰ ਬੈਠ ਮੈਂ ਤੈਨੂੰ ਠੀਕ ਕਰਕੇ ਦਿੰਦੀ ਹਾਂ ਅਸੀਂ ਉਹਨੂੰ ਬਿਠਾ ਲਈ ਦਾ ਕੋਈ ਗੱਲ ਨਹੀਂ ਆਪਣਾ ਅਸੀਂ ਸੂਟ ਬਿਲਕੁਲ ਸਹੀ ਕਰਕੇ ਉਹਨੂੰ ਸਲਵਾਰ ਜਿਵੇਂ ਸਾਡੇ ਤੋਂ ਹੁੰਦਾ ਅਸੀਂ ਫਿਰ ਉਹਨੂੰ ਤਿਆਰ ਕਰਦੇ ਹਾਂ ਫੇਰ ਅਗਲੇ ਨੂੰ ਕਹਿੰਦੇ ਹਾਂ ਦੇ ਦਿਉ ਫੇਰ ਅਗਲਾ ਕਹਿੰਦਾ ਚੱਲੋ ਠੀਕ ਹੈ ਮੇਰੇ ਪਾਉਣ ਜੋਗਾ ਹੋ ਗਿਆ ਅਤੇ ਕੋਈ ਏਦਾਂ ਦੀ ਸਮੱਸਿਆ ਨਹੀਂ ਗਲਤ ਕੰਮ ਹੋ ਜਾਂਦੇ ਪਰ ਕੋਈ ਗੱਲ ਨਹੀਂ ਆਪਾਂ ਉਸ ਨੂੰ ਸੁਧਾਰਨਾ ਸਾਡੇ ਹੱਥ 'ਚ ਹੁੰਦਾ ਅਤੇ ਅਸੀਂ ਉਸ ਨੂੰ ਸੁਧਾਰ ਸਕਦੇ ਹਾਂ